ਪਹਿਲਾਂ ਦੇ ਸਮੇਂ ਵਿੱਚ ਤੈਕਨੋਲਜੀ ਦੀ ਬਹੁਤ ਘਾਟ ਸੀ ਪਰ ਅੱਜ ਦੇ ਯੁੱਗ ਵਿੱਚ ਤੈਕਨੋਲਜੀ ਬਹੁਤ ਵੱਧ ਚੁੱਕੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਅਸੀਂ ਬਿਜਲੀ ਕਈ ਤਰ੍ਹਾਂ ਨਾਲ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਸੋਲਰ ਪੈਨਲ ਹੋ ਗਏ ਅਤੇ ਪਾਣੀ ਨਾਲ ਅਸੀਂ ਪਾਣੀ ਨਾਲ ਵੀ ਬਿਜਲੀ ਪ੍ਰਾਪਤ ਕਰ ਸਕਦੇ ਹਾਂ ਪਰ ਪਾਣੀ ਨਾਲ ਬਿਜਲੀ ਪ੍ਰਾਪਤ ਕਰਨੀ ਬਹੁਤ ਹੀ ਮਹਿੰਗੀ ਹੁੰਦੀ ਹੈ ਤੇ ਸੋਲਰ ਪੈਨਲ ਨਾਲ ਬਿਜਲੀ ਪ੍ਰਾਪਤ ਕਰਨੀ ਬਹੁਤ ਹੀ ਸੌਖੀ ਹੁੰਦੀ ਹੈ ਅਸੀਂ ਇਸ ਨਾਲ ਕਈ ਤਰ੍ਹਾਂ ਦੀ ਊਰਜਾ ਪ੍ਰਾਪਤ ਕਰ ਸਕਦੇ ਹਾਂ